ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੌਣ ਬੋਲ ਰਿਹਾ ਉੱਧਰ ਹਾਂਜੀ ਤੁਹਾਡਾ ਕੀ ਮਨੋਰਥ ਹੈ ਇਹ ਫੋਨ ਕੋਲ ਕਰਨ ਦਾ ਅੱਛਾ ਜੀ ਇਹ ਜਿਹੜਾ ਨਾ ਬੜਾ ਹੀ ਗੰਭੀਰ ਵਿਸ਼ਾ ਜਿਹੜਾ ਤੁਸੀਂ ਛੋਹਿਆ ਇਕੱਲਾ ਫਤਿਹਗੜ੍ਹ ਸਾਹਿਬ ਹੀ ਨਹੀਂ ਚਲੋ ਤੁਸੀਂ ਹੁਣ ਫਤਿਹਗੜ੍ਹ ਸਾਹਿਬ ਬਾਰੇ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਗੱਲ ਵੱਖਰੀ ਹੈ ਪਰੰਤੂ ਇਹ ਜਿਹੜਾ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਇੱਕ ਕਹਿ ਲਉ ਇੱਕ ਨਵਾਂ ਹੀ ਕਿਸਮ ਦਾ ਸੱਭਿਆਚਾਰ ਉਸਰ ਰਿਹਾ ਕਿ ਬੱਚੇ ਬਹੁਤ ਛੋਟੀ ਉਮਰ ਦੇ ਵਿੱਚ ਆਪਣੇ ਮਾਂ ਬਾਪ ਤੋਂ ਦੂਰ ਹੋ ਜਾਂਦੇ ਨੇ ਸਤਾਰ੍ਹਾਂ ਅਠਾਰ੍ਹਾਂ ਸਾਲ ਦੀ ਉਮਰ ਦੇ ਵਿੱਚ ਅਤੇ ਉਹ ਉਹਨਾਂ ਦਾ ਪਲਾਇਨ ਜਿਹੜਾ ਬਹੁਤ ਤੇਜ਼ੀ ਨਾਲ ਹੋ ਰਿਹਾ ਉਹਦੇ ਕਈ ਕਾਰਨ ਸਾਡੇ ਉਹਦੇ ਧਿਆਨ 'ਚ ਆ ਰਹੇ ਨੇ ਕਿ ਇੱਥੋਂ ਦਾ ਜਿਹੜਾ ਰਾਜਨੀਤਿਕ ਢਾਂਚਾ ਹੈ ਜਿਹਨੇ ਕਿ ਸਮਾਜਿਕ ਵਿਵਸਥਾ ਨੂੰ ਠੀਕ ਤਰੀਕੇ ਨਾਲ ਚਲਾਉਣ ਦੇ ਵਿੱਚ ਵੱਡਾ ਰੋਲ ਤਾਂ ਨਿਭਾਉਣਾ ਸੀ ਉਹ ਉਹ ਜਿਹੜਾ ਹੈ ਥੋੜ੍ਹਾ ਉਹਦੇ ਵਿੱਚ ਭਰੋਸ ਬੇਭਰੋਸਗੀ ਜਿਹੜੀ ਹੈ ਇੱਥੋਂ ਦੇ ਜਿਹੜੇ ਨੌਜਵਾਨਾਂ ਦੀ ਜਿਹੜੀ ਵੱਧਦੀ ਜਾ ਰਹੀ ਹੈ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਭਵਿੱਖ ਹੈ ਉਹ ਬਾਹਰਲੇ ਮੁਲਕਾਂ ਦੇ ਵਿੱਚ ਸੁਰੱਖਿਅਤ ਹੋਵੇਗਾ ਪੱਛਮੀ ਮੁਲਕ ਜਿਵੇਂ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਕੇ ਕੈਨੇਡਾ ਯੂ ਐੱਸ ਏ ਇਹੋ ਜਿਹੇ ਜਿਹੜੇ ਮੁਲਕ ਨੇ ਉਹਨਾਂ ਵੱਲੋਂ ਉਹਨਾਂ ਦਾ ਪਲਾਨ ਵੱਧ ਰਿਹਾ ਬੜੀ ਤੇਜ਼ੀ ਦੇ ਨਾਲ ਅਤੇ ਔਰ ਉਹ ਸਕੂਲੀ ਆਪਣੀ ਸਿੱਖਿਆ ਜਿਹੜੀ ਹੈ ਉਹ ਹਾਈ ਸਕੂਲ ਦੀ ਕਹਿ ਲਉ ਜਾਂ ਸੀਨੀਅਰ ਸੈਕੰਡਰੀ ਦੀ ਕਹਿ ਲਉ ਉਹ ਤੋਂ ਬਾਅਦ ਹੀ ਉਹਨਾਂ ਦਾ ਰੁਝਾਨ ਇਸ ਪਾਸੇ ਹੋ ਚੁੱਕਿਆ ਅਤੇ ਹੋਰ ਕੋਈ ਜਾਣਕਾਰੀ ਤੁਸੀਂ ਇਸ ਸੰਬੰਧੀ ਹਾਸਲ ਕਰਨੀ ਚਾਹੋ ਹਾਂ ਇਹਦੇ 'ਚ ਇੱਕ ਆਰਥਿਕ ਆਰਥਿਕ ਮੰਦ ਹੈ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਨੇ ਉਹਨਾਂ ਦਾ ਪਲਾਇਨ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਜ਼ਿਆਦਾਤਰ ਪੜ੍ਹਦੇ ਨੇ ਅਤੇ ਜਿਹੜੇ ਪ੍ਰਾਈਵੇਟ ਸਕੂਲ ਨੇ ਕੋਂਨਵੈਂਟ ਸਕੂਲ ਨੇ ਉਹਨਾਂ ਦੇ ਵਿੱਚ ਜੋ ਮੱਧ ਵਰਗੀ ਪਰਿਵਾਰ ਨੇ ਉਹਨਾਂ ਦੇ ਬੱਚੇ ਪੜ੍ਹਦੇ ਨੇ ਅਤੇ ਉਹਨਾਂ ਕੋਲ ਇੰਨਾਂ ਸਾਧਨ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਦਸ ਪੰਦਰਾਂ ਵੀਹ ਪੱਚੀ ਲੱਖ ਲਾ ਕੇ ਭੇਜ ਸਕਦੇ ਨੇ ਅਤੇ ਬਾਕੀ ਜਿਹੜੇ ਹਾਂਜੀ ਨਹੀਂ ਵਿੱਦਿਅਕ ਢਾਂਚੇ 'ਚ ਕੋਈ ਨੁਕਸ ਨੀ ਹੈ ਬਸ ਇੰਨਾਂ ਕੀ ਹੈ ਕਿ ਜਿਹੜੀ ਸਹੀ ਜਿਹੜੀ ਉਹਨਾਂ ਨੂੰ ਉਤਸ਼ਾਹ ਕਰਨ ਦੀ ਲੋੜ ਹੈ ਉਤਸ਼ਾਹਿਤ ਕਰਨ ਦੀ ਲੋੜ ਹੈ ਉਤਸ਼ਾਹ ਦੀ ਲੋੜ ਹੈ ਤਾਂ ਕਿ ਉਹ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਵਜ਼ੀਫੇ ਲੈ ਕੇ ਅਤੇ ਦੁਨੀਆਂ ਦੀ ਵੱਡੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਪੜ੍ਹਨ ਅਤੇ ਅਗਲਾ ਤਾਂ ਕੰਮ ਜਾਰੀ ਰੱਖਣ ਸੋ ਆਏ ਮੈਨੂੰ ਲੱਗਦਾ ਹੈ ਮੈਂ ਸੋਚ ਸੋਚਦਾਂ ਕਿ ਤੁਹਾਡੇ ਲਈ ਇਹ ਜਾਣਕਾਰੀ ਭਰਪੂਰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ